ਹਾਂਜੀ ਮੈਂ ਇੱਕ ਯਾਦਗਾਰ ਅਨੁਭਵ ਸਾਂਝਾ ਕਰਨਾ ਚਾਹੁੰਦਾ ਹਾਂ ਜਿੱਥੇ ਮੈਂ ਆਪਣੀ ਡਰਾਇੰਗ ਬਾਰੇ ਫੀਡਬੈਕ ਪ੍ਰਾਪਤ ਕੀਤੀ ਸੀ ਜਦੋਂ ਮੈਂ ਪਲੱਸ ਟੂ ਵਿੱਚ ਸੀ ਤਾਂ ਮੈਂ ਇੱਕ ਕੰਪਟੀਸ਼ਨ ਵਿੱਚ ਭਾਗ ਲਿਆ ਸੀ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਵੈਸੇ ਤਾਂ ਮੈਂ ਆਪਣੀ ਡਰਾਇੰਗ ਕਰਦੇ ਸਮੇਂ ਕੋਈ ਕਮੀ ਨਹੀਂ ਛੱਡਦਾ ਮੈਂ ਦਿਲ ਲਾ ਕੇ ਡਰਾਇੰਗ ਕਰਦਾ ਹਾਂ ਜਦੋਂ ਮੈਂ ਆਪਣੀ ਡਰਾਇੰਗ ਦਿਖਾਈ ਸੀ ਤਾਂ ਮੈਨੂੰ ਵੈਸੇ ਤਾਂ ਬਹੁਤ ਵਧੀਆ ਫੀਡਬੈਕ ਮਿਲੀ ਫੀਡਬੈਕ ਮਿਲਣ ਦਾ ਫਾਇਦਾ ਕਿਉਂਕਿ ਫੀਡਬੈਕ ਦਾ ਮਤਲਬ ਗੁਡ ਕਮੈਂਟਸ ਹੀ ਨਹੀਂ ਹੁੰਦਾ ਫੀਡਬੈਕ ਲੈਂਦੇ ਸਮੇਂ ਸਾਨੂੰ ਜਿਹੜੀਆਂ ਕਮੀਆਂ ਹੁੰਦੀਆਂ ਹਨ ਉਹਨਾਂ ਦਾ ਵੀ ਪਤਾ ਲੱਗਦਾ ਹੈ ਪੋਜੀਟਿਵ ਫੀਡਬੈਕ ਐਂਡ ਨੈਗੇਟਿਵ ਫੀਡਬੈਕ ਦੋਨੋਂ ਤਰ੍ਹਾਂ ਦੀ ਮਿਲਦੀ ਹੈ ਜਿਸ ਨਾਲ ਮੈਂ ਆਪਣੀ ਡਰਾਇੰਗ ਵਿੱਚ ਜਿਹੜੀਆਂ ਕਮੀਆਂ ਉਹਨਾਂ ਨੂੰ ਸੁਧਾਰਿਆ ਮੈਨੂੰ ਜਿਹੜੀ ਨੈਗਟਿਵ ਫੀਡਬੈਕ ਮਿਲੀ ਸੀ ਮੈਂ ਉਸ ਨੂੰ ਆਪਣੀ ਡਰਾਇੰਗ ਪ੍ਰਕਿਰਿਆ ਵਿੱਚ ਸ਼ਾਮਿਲ ਕੀਤਾ ਤੇ ਅੱਗੇ ਤੋਂ ਡਰਾਇੰਗ ਕਰਦੇ ਸਮੇਂ ਧਿਆਨ ਰੱਖਿਆ